ਹੈਲੋ ਹੈਲੋ ਗੁੱਡ ਮੋਰਨਿੰਗ ਮੈਮ ਮੈਮ ਅੱਜ ਕੱਲ੍ਹ ਨਾ ਜਿਹੜੇ ਬੱਚੇ ਹੈਗੇ ਹੈ ਜਿਹੜੇ ਪੜ੍ਹਦੇ ਨਹੀਂ ਹੈਗੇ ਉਹ ਕਲਾਸ ਦੇ ਵਿੱਚ ਨਾ ਬਹੁਤ ਪ੍ਰੋਬਲਮ ਕ੍ਰੀਏਟ ਕਰ ਰਹੇ ਆ ਉਹ ਪੜ੍ਹਾਉਣ ਹੀ ਨਹੀਂ ਦਿੰਦੇ ਪਿਛੋਂ ਇੰਨਾ ਰੋਲਾ ਪਾਉਂਦੇ ਹੈ ਨਾ ਬਾਕੀ ਜਿਹੜੇ ਪੜ੍ਹਨ ਵਾਲੇ ਹੈ ਉਹਨਾਂ ਨੂੰ ਵੀ ਡਿਸਟਰਬ ਕਰ ਦਿੰਦੇ ਅਤੇ ਉਹਨਾਂ ਨੂੰ ਬਹੁਤ ਪ੍ਰੋਬਲਮ ਰਹੀ ਮੈਮ ਐਂਡ ਮੇਰੇ ਕੋਲ ਪੇਰੈਂਸਟਸ ਆ ਰਹੇ ਹੈ ਕਹਿ ਰਹੇ ਆ ਕਿ ਜਿਹੜੇ ਸਾਡੇ ਬੱਚੇ ਪੜ੍ਹਨ ਵਾਲੇ ਹੈ ਉਹਨਾਂ ਦਾ ਕੋਈ ਸਲਿਊਸ਼ਨ ਕੱਢੋ ਕੁਛ ਉਹਨਾਂ ਦਾ ਸੈਕਸ਼ਨ ਦਾ ਕੁਛ ਕਰੋ ਵੱਖਰਾ ਵੱਖਰਾ ਤਾਂ ਜੋ ਇਹਨਾਂ ਨੂੰ ਮਤਲਬ ਅਲੱਗ ਕੀਤਾ ਜਾ ਸਕੇ ਜਿਹੜੇ ਬੱਚੇ ਪੜ੍ਹਨ ਵਾਲੇ ਆ ਅਤੇ ਜਿਹੜੇ ਨਹੀਂ ਪੜ੍ਹਨ ਵਾਲੇ ਕੀ ਕਰਾਂ ਮੈਮ ਤੁਸੀਂ ਕੋਈ ਸਲਿਊਸ਼ਨ ਦਿਉ ਮੈਮ ਮੈਂ ਤਾਂ ਹੈਂਡਲ ਕਰ ਹੀ ਰਹੀ ਹਾਂ ਉਹਨਾਂ ਨੂੰ ਬਟ ਪ੍ਰੋਬਲਮ ਇਹ ਆ ਰਹੀ ਹੈ ਕਿ ਉਹ ਪੜ੍ਹਨਾ ਹੀ ਨਹੀਂ ਚਾਹੁੰਦੇ ਕੁਛ ਇੱਦਾਂ ਦੀ ਉਹ ਐਕਚੁਅਲੀ ਉਹਨਾਂ ਦਾ ਦਿਮਾਗ ਹੀ ਸ਼ਰਾਰਤਾਂ ਦੇ ਵਿੱਚ ਲੱਗਾ ਹੋਇਆ ਉਹ ਚਾਹੁੰਦੇ ਨਾ ਤਾਂ ਉਹ ਖੁਦ ਪੜ੍ਹਨ ਅਤੇ ਜਿਹੜੇ ਪੜ੍ਹਨ ਵਾਲੇ ਉਹਨਾਂ ਨੂੰ ਵੀ ਡਿਸਟਰਬ ਕਰਦੇ ਉਹਨਾਂ ਦੀ ਵੀ ਗ੍ਰੋਥ ਰੋਕਦੇ ਪਏ ਖੁਦ ਤਾਂ ਉਹਨਾਂ ਨੇ ਕੁਛ ਕਰਨਾ ਨਹੀਂ ਉਹਨਾਂ ਨੂੰ ਵੀ ਥੱਲੇ ਸੁੱਟੀ ਜਾਂਦੇ ਆਪਣੇ ਨਾਲ ਮੈਮ ਪਨਿਸ਼ਮੈਂਟ ਤਾਂ ਮੈਂ ਦੇ ਹੀ ਨਹੀਂ ਸਕਦੀ ਤੁਹਨੂੰ ਤਾਂ ਪਤਾ ਹੀ ਹੈ ਅੱਜ ਕੱਲ੍ਹ ਕੀ ਲੋਅ ਆ ਗਏ ਹੋਏ ਹੈ ਪੇਰੈਂਟਸ ਆਉਂਦੇ ਤੁਸੀਂ ਸਾਡੇ ਬੱਚੇ 'ਤੇ ਹੱਥ ਕਿਵੇਂ ਚੁੱਕ ਲਿਆ ਤੁਸੀਂ ਕ ਮਤਲਬ ਟੀਚਰ ਹੋ ਮਤਲਬ ਇਸ ਤਰ੍ਹਾਂ ਤੁਸੀਂ ਨਹੀਂ ਡਾਂਟ ਸਕਦੇ ਫਿਰ ਮੈਂ ਕਿਵੇਂ ਕਰਾਂ ਨਾ ਹਾਂਜੀ ਮੈਮ ਉਹ ਤਾਂ ਫਿਰ ਕਰਨਾ ਹੀ ਪਏਗਾ ਬਟ ਉਹਨਾਂ ਦਾ ਧਿਆਨ ਬਹੁਤ ਜ਼ਿਆਦਾ ਸ਼ਰਾਰਤਾਂ ਵੱਲ ਹੈ ਐਂਡ ਮੇਰਾ ਤਾਂ ਵਿਚਾਰ ਹੈ ਕਿ ਇਹਨਾਂ ਦਾ ਸੈਕਸ਼ਨ ਅਲੱਗ ਕਰ ਦੀਏ ਜਿਹੜੇ ਪੜ੍ਹਨ ਵਾਲੇ ਉਹਨਾਂ ਦਾ ਵੱਖਰਾ ਕਰ ਦੀਏ ਅਤੇ ਜਿਹੜੇ ਨਹੀਂ ਪੜ੍ਹਦੇ ਉਹਨਾਂ ਦਾ ਵੱਖਰਾ ਕਰ ਦੀਏ ਤਾਂ ਜੋ ਇਹਨਾਂ ਵੱਲ ਹੋਰ ਤਰੀਕੇ ਦੀ ਕੰਨਸਨਟੇਸ਼ਨ ਲਾਈ ਜਾ ਸਕੇ ਅਤੇ ਉਹਨਾਂ ਨੂੰ ਹੋਰ ਤਰੀਕੇ ਨਾਲ ਪੜ੍ਹਾਇਆ ਜਾ ਸਕੇ ਕਿਉਂਕਿ ਪੜ੍ਹਨ ਵਾਲਿਆਂ ਨੂੰ ਤਾਂ ਗਾਈਡ ਹੀ ਕਰਨਾ ਹੈ ਅਸੀਂ ਬਟ ਇਹਨਾਂ ਨੂੰ ਡਿਸਿਪਲਿਨ ਸਿਖਾਉਣਾ ਪੈਣਾ ਇਹ ਪ੍ਰੋਬਲਮ ਕਰਦੇ ਪਏ ਇਕੱਠੇ ਹੋ ਕੇ ਅੱਛਾ

ਠੀਕ ਹੈ ਮੈਮ ਮੈਮ ਆਹੀ ਪ੍ਰੋਬਲਮ ਆ ਰਹੀ ਸੀ ਬਹੁਤ ਮੈਂ ਕੱਲ੍ਹ ਹੀ ਇਹਹੀ ਨੂੰ ਕੋਲ ਕਰਦੀ ਹਾਂ ਸਾਰਿਆਂ ਨੂੰ ਬੁਲਾਉਂਦੀ ਹਾਂ ਅਤੇ ਜਿਹੜੇ ਬੱਚੇ ਪ੍ਰੋਬਲਮ ਕ੍ਰੀਏਟ ਕਰਦੇ ਆ

ਹਾਂਜੀ ਮੈਮ

ਠੀਕ ਹੈ ਮੈਮ

ਅੱਛਾ

ਹਾਂਜੀ ਮੈਮ ਕੋਈ ਗੱਲ ਨਹੀਂ ਕੋਈ ਇਸ਼ੂ ਨਹੀਂ ਮੈਨੂੰ ਤਾਂ ਉਹ ਮੈਮ ਡਾਸਿੰਗ ਕਰਵਾ ਲਾਂਗੀ ਕੁਛ ਬੱਚੇ ਜਿਹੜੇ ਡਾਂਸ 'ਚ ਵਧੀਆ ਹੈਗੇ ਹੈ ਉਹਨਾਂ ਨੂੰ ਕਰਵਾ ਦਾਂਗੀ ਕੁਛ ਜਿਹੜੇ ਸਿਗਿੰਗ 'ਚ ਉਹਦਾ ਕਰਵਾ ਦਾਂਗੀ ਸਟਾਟਿੰਗ ਸ਼ਬਦ ਤੋਂ ਕਰ ਲਾਂਗੇ ਸ਼ਬਦ ਬੁਲਵਾਦਾਂਗੀ ਇੱਕ ਸਟਾਰਟਿੰਗ ਤੋਂ ਅਤੇ ਥੋੜ੍ਹੀ ਜਿਹੀ ਡਾਂਸ ਦੀਆਂ ਆ ਜਾਣਗੀਆਂ ਐਟਮਸ ਐਂਡ ਥੋੜ੍ਹੀ ਜਿਹੀ ਸਟੇਟ ਸਿੰਗਿਗ ਵੀ ਆ ਜਾਣਗੀਆਂ ਇੱਕ ਰੋਲ ਪਲੇ ਦਾ ਪੂਰਾ ਡਰਾਮਾ ਕ੍ਰੀਏਟ ਕਰ ਲਾਂਗੇ ਉਹਦੇ ਲਈ ਵੱਖਰੇ ਬੱਚੇ ਲੈ ਕੇ ਆਉਂਗੀ ਠੀਕ ਹੈ ਮੈਮ ਹਾਂਜੀ

ਠੀਕ ਹੈ ਰਚਨਾ ਮੈਮ ਲੈ ਲਵਾਂ ਅਹ ਠੀਕ ਹੈ ਠੀਕ ਹੈ ਮੈਮ

ਮੈਮ ਉਹ ਤਾਂ ਅੰਮ੍ਰਿਤਾ ਮੈਮ ਕਰਾ ਸਕਦੇ ਬਹੁਤ ਵਧੀਆ ਹਾਂਜੀ ਠੀਕ ਹੈ ਮੈਮ ਠੀਕ ਹੈ ਮੈਮ ਓਕੇ